ਹਾਂਜੀ ਤੁਸੀਂ ਮਨੀਰਾਮ ਦੀ ਹੱਟੀ ਪੰਜਾਬੀ ਜੁੱਤੀ ਵਾਲੇ ਦੀ ਦੁਕਾਨ ਤੋਂ ਬੋਲ ਰਹੇ ਹੋ ਮੈਂ ਹੁਣ ਥੋੜ੍ਹੀ ਦੇਰ ਪਹਿਲਾਂ ਤੁਹਾਡੀ ਦੁਕਾਨ ਦੀ ਵੈਬਸਾਈਟ ਦੇਖ ਰਿਹਾ ਸੀ ਉੱਥੇ ਜੁੱਤੀਆਂ ਦੇ ਬਹੁਤ ਹੀ ਅਲੱਗ ਅਲੱਗ ਪ੍ਰਕਾਰ ਅਤੇ ਰੰਗ ਵੀ ਮੈਂ ਵੇਖੇ ਹੈ ਅਤੇ ਮੈਂ ਤੁਹਾਡੀ ਦੁਕਾਨ ਬਾਰੇ ਵੀ ਬਹੁਤ ਜ਼ਿਆਦਾ ਸੁਣਿਆ ਹੈ ਕੀ ਮੈਨੂੰ ਦੱਸ ਸਕਦੇ ਹੋ ਕਿ ਮਤਲਬ ਕਿਸ ਤਰ੍ਹਾਂ ਦੀ ਜੁੱਤੀ ਤੁਹਾਡੇ ਕੋਲ ਅਵੇਲੇਬਲ ਹੈ ਕਿਸ ਤਰ੍ਹਾਂ ਦਾ ਰੰਗ ਅਤੇ ਆਕਾਰ ਵਿੱਚ ਉਪਲਬਧ ਹਨ ਕਿਉਂਕਿ ਮੈਨੂੰ ਜੁੱਤੀਆਂ ਦੋ ਤਿੰਨ ਤਰ੍ਹਾਂ ਦੀ ਚਾਹੀਦੀਆਂ ਹਨ ਇੱਕ ਤਾਂ ਜੁੱਤੀ ਹੋਵੇ ਜਿਹੜੀ ਮੈਂ ਰੋਜ਼ ਆ ਅੰਦਰ ਬਾਹਰ ਪਾ ਸਕਾਂ ਜਾਂ ਜਿਵੇਂ ਕਿ ਮੈਂ ਬਾਜ਼ਾਰ ਜਾਣਾ ਹੈ ਜਾਂ ਕੋਈ ਕੰਮ ਕਰਨ ਜਾਣਾ ਉਹ ਵੀ ਪਾ ਸਕਾਂ ਅਤੇ ਦੂਸਰੀ ਮੈਨੂੰ ਇੱਕ ਚਾਹੀਦੀ ਹੈ ਥੋੜ੍ਹੀ ਪਾਰਟੀ ਵਿਅਰ ਜੁੱਤੀ ਚਾਹੀਦੀ ਹੈ ਚਾਹੇ ਜੋ ਜ਼ਿਆਦਾ ਚਲਾਊ ਨਾ ਹੋਵੇ ਪਰ ਥੋੜ੍ਹੀ ਦੇਖਣ 'ਚ ਫੈਂਸੀ ਟਾਈਪ ਜਿਹੀ ਹੋਵੇ ਉਹ ਵਧੀਆ ਜੁੱਤੀ ਲੱਗੇ ਉਹ ਮੈਂ ਜਿਵੇਂ ਕੋਈ ਛੋਟੇ ਮੋਟੇ ਕੋਈ ਫੰਕਸ਼ਨ ਹੈ ਲੋਕਲ ਹੀ ਮੈਂ ਸ਼ ਫੰਕਸ਼ਨ 'ਤੇ ਜਾਣਾ ਹੈ ਮੈਂ ਉੱਥੇ ਪਾ ਸਕਾਂ ਅਤੇ ਮੈਨੂੰ ਇੱਕ ਜੁੱਤੀ ਹੋਰ ਚਾਹੀਦੀ ਹੈ ਜਿਹੜੀ ਕਿ ਵਧੀਆ ਕੁਆਲਿਟੀ 'ਚ ਹੋਵੇ ਅਤੇ ਕਿਉਂਕਿ ਮੈਂ ਕਿਉਂਕਿ ਅਗਲੇ ਮਹੀਨੇ ਹੀ ਮੇਰੇ ਕਜ਼ਨ ਦੀ ਸ਼ਾਦੀ ਹੈ ਮੈਂ ਉੱਥੇ ਜਾਣਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਕੁੜਤੇ ਪਜਾਮੇ ਨਾਲ ਵਧੀਆ ਪੰਜਾਬੀ ਜੁੱਤੀ ਪਾਵਾਂ ਕਿਉਂਕਿ ਪੰਜਾਬੀ ਜੁੱਤੀ ਕੁੜਤੇ ਪਜਾਮੇ ਨਾਲ ਹੀ ਚੱਲੂਗੀ ਅਤੇ ਮੈਨੂੰ ਵਧੀਆ ਤਿੱਲੇਦਾਰ ਅਤੇ ਹੈਂਡਵਰਕ ਦੀ ਜੁੱਤੀ ਚਾਹੀਦੀ ਹੈ ਜੁੱਤੀ ਹੋਵੇ ਵਧੀਆ ਅਤੇ ਟਿਕਾਊ ਹੋਣੀ ਚਾਹੀਦੀ ਹੈ ਅਤੇ ਚਲਾਊ ਜੁੱਤੀ ਹੋਵੇ ਕਿਉਂਕਿ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਮੈਂ ਤੁਹਾਡੇ ਨਾਲ ਬੜੇ ਹੀ ਮਾਣ ਨਾਲ ਅਤੇ ਪੂਰੇ ਵਿਸ਼ਵਾਸ ਨਾਲ ਤੁਹਾਨੂੰ ਫੋਨ ਕਰ ਰਿਹਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾ ਤੁਸੀਂ ਮੈਨੂੰ ਚੀਜ਼ ਵਧੀਆ ਹੀ ਦਿਓਗੇ ਬਸ ਮੈਨੂੰ ਕੁਆਲਟੀ ਵਧੀਆ ਦ ਚਾਹੀਦੀ ਹੈ ਪੈਸਿਆਂ ਦੀ ਮੈਨੂੰ ਕੋਈ ਚਿੰਤਾ ਨਹੀਂ ਬਸ ਕੁਆਲਿਟੀ ਵਧੀਆ ਦੇ ਦਿਓ ਬਾਕੀ ਮੈਂ ਹੋ ਸਕਿਆ ਤਾਂ ਤੁਹਾਡੀ ਦੁਕਾਨ 'ਤੇ ਵਿਜਿਟ ਕਰਨ ਦੀ ਕੋਸ਼ਿਸ਼ ਕਰਾਂਗਾ ਜਾਂ ਮੈਨੂੰ ਹੋ ਸਕਿਆ ਤਾਂ ਤੁਸੀਂ ਮੈਨੂੰ ਹੋਮ ਡਿਲੀਵਰੀ ਹੈ ਤਾਂ ਤੁਹਾਡੀ ਜੇਕਰ ਹੋਮ ਡਿਲੀਵਰੀ ਕਰਵਾ ਦਿਓ ਧੰਨਵਾਦ ਜੀ